ਭੰਗੜਾ ਅਤੇ ਐਰੋਬਿਕਸ ਨੂੰ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕੋਰਿਓਗ੍ਰਾਫੀ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਭੰਗੜਾ ਅਤੇ ਐਰੋਬਿਕਸ ਦੋਵੇਂ ਹੀ ਸ਼ਕਤੀਸ਼ਾਲੀ ਅਤੇ ਉਤਸ਼ਾਹ ਭਰਪੂਰ ਗਤੀਵਿਧੀਆਂ ਹਨ ਪਰ ਇਹਨਾਂ ਦੀ ਕੋਰੀਓਗ੍ਰਾਫੀ ਬਣਾਉਣ ਲਈ ਕੁਛ ਖਾਸ ਚੀਜ਼ਾਂ ਦਾ ਕਾਫੀ ਧਿਆਨ ਰੱਖਣਾ ਪੈਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਗਾਣੇ ਦੀ ਚੋਣ ਕਰਨੀ ਪੈਂਦੀ ਹੈ ਜਿੱਦਾਂ ਕਿ ਇੱਕ ਉਤਸ਼ਾਹ ਭਰਿਆ ਭੰਗੜੇ ਵਾਲਾ ਗਾਣਾ ਜਾਂ ਐਰੋਬਿਕਸ ਲਈ ਸਾਨੂੰ ਇੱਕ ਕਾਫੀ ਤੇਜ਼ ਗਤੀਵਿਧੀ ਅਲੱਗ ਗੀਤ ਸ ਚੋਣ ਕਰਨਾ ਪੈਂਦਾ ਹੈ ਭੰਗੜੇ ਲਈ ਭੰਗੜਾ ਕਰਨ ਲਈ ਜਾਂ ਪਾਪੇ ਹੈ ਵਰਗੇ ਗੀਤ ਜਦਕਿ ਐਰੋਬਿਕਸ ਲਈ ਤੇਜ਼ ਬੀਟ ਵਾਲਾ ਵਧੀਆ ਚੋਣ ਕਰਨਾ ਪੈਂਦਾ ਹੈ ਮੂਵਮੈਂਟਸ ਦੀ ਯੋਜਨਾ ਬਣਾਉਣੀ ਪੈਂਦੀ ਹੈ ਭੰਗੜਾ ਸਾਧਾਰਨ ਸਟੈਪਸ ਨਾਲ ਨਹੀਂ ਕੀਤਾ ਜਾਂਦਾ ਇਹਦੇ ਵਿੱਚ ਸਾਨੂੰ ਹੱਥਾਂ ਅਤੇ ਪੈਰਾਂ ਦੀ ਮੂਮੈਂਟ ਅਤੇ ਬਾਡੀ ਦਾ ਇੱਕ ਵਧੀਆ ਪੋਸਚਰ ਮੈਨਟੇਨ ਕਰਨਾ ਪੈਂਦਾ ਹੈ ਕੁੱਦਕ ਹੱਥ ਲਹਿਰਾਉਣ 'ਤੇ ਟਿੱਕਾ ਮਾਰਨਾ ਵੀ ਪੂ ਪੂਰੇ ਉਤਸ਼ਾਹ ਨਾਲ ਕਰਨਾ ਪੈਂਦਾ ਹੈ ਜਦਕਿ ਐਰੋਬਿਕਸ ਵਿੱਚ ਸਾਨੂੰ ਅਲੱਗ ਅਲੱਗ ਤਰੀਕੇ ਦੇ ਸਟੈਪ ਕਰਨੇ ਪੈਂਦੇ ਹਨ ਇਹ ਸਾਡੇ ਦਿਲ ਦੀ ਗਤੀਵਿਧੀ ਨੂੰ ਤੇਜ਼ ਵੀ ਕਰਦਾ ਹੈ ਅਤੇ ਸਾਨੂੰ ਤੰਦਰੁਸਤ ਰੱਖਣ ਵਿੱਚ ਕਾਫੀ ਸਹਾਇਤਾ ਕਰਦਾ ਹੈ ਅਤੇ ਸਾਧਾਰਨ ਤੋਂ ਉੱਨਤ ਤੱਕ ਜਾਣ ਲਈ ਹਮੇਸ਼ਾ ਸਾਨੂੰ ਸਾਡੇ ਸਟੈਪ ਉੱਤੇ ਕਾਫੀ ਗੌਰ ਕਰਨਾ ਪੈਂਦਾ ਹੈ ਤਾਂ ਜੋ ਨਵੇਂ ਵਿਅਕਤੀ ਜਿਹੜੇ ਸਿੱਖਣਾ ਚਾਹੁੰਦੇ ਹਨ ਉਹਨਾਂ ਲਈ ਸਾਨੂੰ ਇਸ ਤਰੀਕੇ ਦਾ ਗੀਤ ਚੋਣ ਕਰਨਾ ਚਾਹੀਦਾ ਹੈ ਜਿਹਦੇ ਨਾਲ ਉਹ ਆਸਾਨ ਤਰੀਕੇ ਨਾਲ ਐਰੋਬਿਕਸ ਜਾਂ ਭੰਗੜਾ ਸਿੱਖ ਸਕੇ ਉਸ ਤੋਂ ਬਾਅਦ ਇਸ ਦਾ ਇੱਕ ਸਮਾਂ ਵੀ ਸਾਨੂੰ ਚੋਣ ਕਰਨਾ ਪੈਂਦਾ ਹੈ ਜਿੱਦਾਂ ਕਿ ਕੋਰੀਓਗ੍ਰਾਫੀ ਬਣਾਉਂਦੇ ਸਮੇਂ ਸਰੀਰ ਦੀ ਕੰਡੀਸ਼ਨ ਦੇਖਣੀ ਪੈਂਦੀ ਹੈ ਬੰਦੇ ਦਾ ਕਾਫੀ ਸੰਤੁਲਨ ਹੋਣਾ ਚਾਹੀਦਾ ਹੈ ਕਿਉਂਕਿ ਭੰਗੜਾ ਅਤੇ ਅਰੋਬਿਕਸ ਦੋਨੋਂ ਹੀ ਇੱਦਾਂ ਦੀ ਗਤੀਆਂ ਗਤੀਵਿਧੀਆਂ ਹਨ ਜਿਹਨਾਂ ਵਿੱਚ ਸਾਨੂੰ ਕਾਫੀ ਕੁਛ ਦੇਖ ਕੇ ਧਿਆਨ ਰੱਖ ਕੇ ਕੰਮ ਕਰਨਾ ਚਾਹੀਦਾ ਹੈ ਆਹ ਸਾਰਾ ਕਰਨ ਤੋਂ ਬਾਅਦ ਸਾਨੂੰ ਡੇਲੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਗਤੀਵਿਧੀਆਂ ਵਿੱਚ ਥੋੜ੍ਹੀ ਮੁਹਾਰਤ ਹਾਸਲ ਕਰ ਸਕਣ